ਵੈਸੇ ਤਾਂ ਸਾਡੇ ਖੇਤਰ ਵਿੱਚ ਗਾਈਡ ਜਾਂ ਸੇਵਾ ਪ੍ਰਦਾਤਾ ਬਹੁਤ ਸਾਰੇ ਹੈਗੇ ਹੈ ਉਹ ਜਿਹੜੇ ਉੱਥੇ ਟੂਰੇਸਟ ਆਉਂਦੇ ਹੈਗੇ ਹੈ ਜਿਹੜੇ ਸਾਡੇ ਸਥਾਨਕ ਇਲਾਕੇ ਵਿੱਚੋਂ ਟੂਰੇਸਟ ਆਉਂਦੇ ਹੈਗੇ ਹੈ ਉਹਨਾਂ ਨੂੰ ਜਿਹੜੇ ਇੱਥੇ ਦੇ ਇਤਿਹਾਸਿਕ ਸਥਾਨ ਹੈ ਅਤੇ ਹੋਰ ਵੀ ਜਿਹੜੇ ਘੁੰਮਣਯੋਗ ਸਥਾਨ ਹੈ ਬਹੁਤ ਜ਼ਿਆਦਾ ਘੁੰਮਾਉਂਦੇ ਹੈਗੇ ਹੈ ਸਭ ਨਾਲੋਂ ਪਹਿਲਾਂ ਜਿੱਦਾਂ ਆਪਾਂ ਅਨੰਦਪੁਰ ਅਨੰਦਪੁਰ ਵੱਲੋਂ ਸ਼ੁਰੂ ਕੀਤਾ ਜਾਵੇ ਅਨੰਦਪੁਰ ਸਾਹਿਬ ਉੱਥੇ ਖਾਲਸਾ ਪੰਥ ਦੀ ਸਿਰਜਣਾ ਕੇਸਗੜ੍ਹ ਸਾਹਿਬ ਅਤੇ ਹੋਰ ਗੁਰਦੁਆਰੇ ਜਿੱਦਾਂ ਕਿ ਵਿਰਾਸਤ ਏ ਖਾਲਸਾ ਜਾਂ ਉੱਥੇ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਗੁਰਦੁਆਰੇ ਜਾਂ ਪੰਜ ਪਿਆਰਾ ਪਾਰਕ ਏ ਅਤੇ ਉਹਨਾਂ ਵਿੱਚੋਂ ਬਹੁਤ ਜ਼ਿਆਦਾ ਘੁੰਮਾਇਆ ਜਾਂਦਾ ਹੈਗਾ ਅਤੇ ਉਥੋਂ ਬਾਅਦ ਜੇ ਆਪਾਂ ਕੀਰਤਪੁਰ ਸਾਹਿਬ ਆ ਜਾਈਏ ਤਾਂ ਕੀਰਤਪੁਰ ਸਾਹਿਬ ਵੀ ਗੁਰਦੁਆਰਿਆਂ 'ਚ ਘੁੰਮਾਇਆ ਜਾਂਦਾ ਹੈਗਾਂ ਏ ਅਤੇ ਇੱਦਾਂ ਉਹ ਤੋਂ ਬਾਅਦ ਆਪਾਂ ਰੋਪੜ ਰੋਪੜ ਇੱਦਾਂ ਹੈੱਡ ਵਰਕ ਸਤਲੁਜ ਰੀਵਰ ਅਤੇ ਹੋਰ ਜਗ੍ਹਾ ਵੀ ਘੁੰਮਾਇਆ ਜਾਂਦਾ ਹੈਗਾ ਉਹ ਤੋਂ ਬਾਅਦ ਉਹੋ ਕੇ ਇੱਥੇ ਚਮਕੌਰ ਸਾਹਿਬ ਚਮਕੌਰ ਸਾਹਿਬ ਵੀ ਇੱਥੇ ਅਲੱਗ ਅਲੱਗ ਗੁਰਦੁਆਰਿਆਂ 'ਚ ਘੁੰਮਾਇਆ ਜਾਂਦਾ ਹੈਗਾ ਏ ਅਤੇ ਉਹ ਅਲੱਗ ਕਈ ਤਰ੍ਹਾਂ ਦੀਆਂ ਭਾਸ਼ਾਵਾਂ ਬੋਲ ਸਕਦੇ ਹੈਗੇ ਹੈ ਜਿੱਦਾਂ ਪੰਜਾਬੀ ਹੋ ਗਈ ਹਿੰਦੀ ਉੜਦੂ ਮਰਾਠੀ ਅੰਗਰੇਜ਼ੀ ਇਸ ਤਰ੍ਹਾਂ ਉਹ ਕਾਫ਼ੀ ਭਾਸ਼ਾਵਾਂ ਬੋਲ ਸਕਦੇ ਏ ਜੀ